ਡੇਂਗੂ ਅਤੇ ਮੱਛਰ ਵਾਲੀਆਂ ਬਿਮਾਰੀਆਂ ਸਾਡੇ ਦੇਸ਼ ਵਿੱਚ ਪ੍ਰਤਿਤ ਪ੍ਰਤੀ ਦਿਨ ਬਹੁਤ ਸਾਰਾ ਵਾਧਾ ਹੋ ਰਿਹਾ ਹੈ ਇਹਨਾਂ ਬਿਮਾਰੀਆਂ ਦਾ ਹੋਣ ਦਾ ਮੁੱਖ ਕਾਰਨ ਮੱਛਰਾਂ ਮੱਛਰ ਹਨ ਇਹ ਬਿਮਾਰੀਆਂ ਆਮ ਤੌਰ 'ਤੇ ਸਫਾਈ ਨਾ ਹੋਣ ਕਰਕੇ ਹੁੰਦੀਆਂ ਹਨ ਇਹਨਾਂ ਬਿਮਾਰੀਆਂ ਦਾ ਇਹਨਾਂ ਬਿਮਾਰੀਆਂ ਵਿੱਚ ਜਾਂ ਬਹੁਤ ਤੇਜ਼ ਬੁਖਾਰ ਹੁੰਦਾ ਹੈ ਅਤੇ ਅੱਖਾਂ ਵਿੱਚ ਦਰਦ ਰਹਿੰਦਾ ਹੈ ਬੰਦੇ ਦੇ ਪਲੇਟਲੈਟਸ ਘੱਟ ਜਾਂਦੇ ਹਨ ਜਿਸ ਕਰਕੇ ਇਸ ਦੀ ਰੋਕਥਾਮ ਲਈ ਸਾਨੂੰ ਬਹੁਤ ਸਾਰੇ ਬਚਾਉ ਦੀ ਲੋੜ ਹੈ ਸਭ ਤੋਂ ਪਹਿਲਾਂ ਸਾਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਜਿਸ ਵਿੱਚ ਪੂਰੀ ਤ ਪੂਰੀਆਂ ਬਾਹਾਂ ਵਾਲ਼ੀਆਂ ਕਮੀਜ਼ਾਂ ਜਾਂ ਪੈਂਟਾਂ ਪਾ ਕੇ ਰੱਖਣੀਆਂ ਚਾਹੀਦੀਆਂ ਆਪਣੇ ਪੈਰਾਂ ਅਤੇ ਹੱਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਕਿਉਂਕਿ ਇਹ ਬਿਮਾਰੀਆਂ ਮੱਛਰ ਕੱਟਣ ਨਾਲ ਹੁੰਦੀਆਂ ਹਨ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਸਾਨੂੰ ਆਪਣੇ ਘਰ ਦੇ ਆਸ ਪਾਸ ਦੀ ਸਫਾਈ ਕਰਨੀ ਬਹੁਤ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਘਰਾਂ ਵਿੱਚ ਕੂਲਰਾਂ 'ਚ ਪਾਣੀ ਪਿਆ ਰਹਿੰਦਾ ਹੈ ਗਮਲਿਆਂ 'ਚ ਖੁੱਲ੍ਹਾ ਪਾਣੀ ਪਿਆ ਰਹਿੰਦਾ ਕਈ ਜਗ੍ਹਾ ਆਪਣੇ ਘਰ ਵਿੱਚ ਖੁੱਲ੍ਹੇ ਭਾਂਡੇ ਜਿਵੇਂ ਕਿ ਅਸੀਂ ਕੁੱਤਿਆਂ ਨੂੰ ਜਾਂ ਜਾਨਵਰਾਂ ਨੂੰ ਪਾਣੀ ਪਾਉਂਦੇ ਹੈ ਉਹ ਭਾਂਡੇ ਵਿੱਚ ਪਾਣੀ ਪਿਆ ਰਹਿੰਦਾ ਹੈ ਜਿਸ ਕਰਕੇ ਮੱਛਰ ਬਹੁਤ ਗਿਣਤੀ ਵਿੱਚ ਵੱਧ ਜਾਂਦੇ ਹਨ ਇਹ ਮੱਛਰ ਜਦੋਂ ਸ਼ਾਮ ਨੂੰ ਸਾਨੂੰ ਕੱਟਦੇ ਹਨ ਤਾਂ ਫਿਰ ਸਾਨੂੰ ਇਹ ਬਿਮਾਰੀਆਂ ਹੋ ਜਾਂਦੀਆਂ ਡੇਂਗੂ ਦੀ ਬਿਮਾਰੀ 'ਚ ਸਾਨੂੰ ਮੱਛਰ ਲੜਨ ਨਾਲ ਸਾਡੇ ਪਲੇਟਲੈਟਸ ਘੱਟ ਜਾਂਦੇ ਹਨ ਸਾਨੂੰ ਫਿਰ ਉਹ ਪਲੇਟਲੈਟਸ ਇਸ ਹੱਦ ਤੱਕ ਘੱਟ ਜਾਂਦੇ ਹਨ ਕਿ ਬੰਦੇ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ ਲੱਤਾਂ 'ਚ ਦਰਦ ਰਹਿਣ ਲੱਗ ਜਾਂਦਾ ਹੈ ਉਹ ਚੱਲ ਫਿਰ ਨਹੀਂ ਸਕਦਾ ਔਰ ਇਹ ਪਲੇਟਲੈਟਸ ਬਹੁਤ ਜ਼ਿਆਦਾ ਗਿਣਤੀ 'ਚ ਘੱਟ ਜਾਂਦੇ ਹਨ ਕਈ ਵਾਰੀ ਇਨਸਾਨ ਨੂੰ ਇਸ ਕੰਡੀਸ਼ਨ ਵਿੱਚ ਹਸਪਤਾਲ ਵਿੱਚ ਵੀ ਭਰਤੀ ਹੋਣਾ ਪੈਂਦਾ ਹੈ ਹਸਪਤਾਲ ਵਿੱਚ ਵੀ ਸਾਨੂੰ ਫਿਰ ਇਸ ਦੀ ਰੋਕਥਾਮ ਲਈ ਪਲੇਟਲੈਟਸ ਚੜ੍ਹਾਉਣੇ ਪੈਂਦੇ ਹਨ ਜਿਹੜੇ ਕਿ ਸੇਮ ਬਲੱਡ ਗਰੁੱਪ ਵਾਲੇ ਬੰਦੇ ਤੋਂ ਹੀ ਲਏ ਜਾਂਦੇ ਹਨ ਇਸ ਦੀ ਰੋਕਥਾਮ ਲਈ ਸਾਨੂੰ ਕਈ ਵਾਰੀ ਆਮ ਕਹਿੰਦੇ ਹਨ ਕਿ ਪਪੀਤੇ ਦੇ ਪੱਤੇ ਕੀਵੀ ਫਰੂਟਸ ਜਾਂ ਅਨਾਰ ਡਰੈਗਨ ਫਰੂਟਸ ਬੱਕਰੀ ਦੇ ਦੁੱਧ ਦਾ ਸੇਵਨ ਕਰਨ ਨਾਲ ਇਹ ਪਲੇਟਲੈਟਸ ਵੱਧਦੇ ਹਨ ਇਹ ਡੇਂਗੂ ਦੀ ਬਿਮਾਰੀ ਦੇ ਬਚਾਉ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਹੋਮੋਪੈਥੀ ਦਵਾਈਆਂ ਵੀ ਆਉਂਦੀਆਂ ਹਨ ਜਿਹੜੀਆਂ ਕਿ ਸਾਨੂੰ ਸਮੇਂ ਸਮੇਂ ਸਿਰ ਲੈਣੀਆਂ ਚਾਹੀਦੀਆਂ ਹਨ ਪਰ ਇਸ ਸਾਰੀਆਂ ਦਵਾਈਆਂ ਦੇ ਬਾਵਜੂਦ ਸਾਨੂੰ ਆਪਣੇ ਆਸ ਪਾਸ ਵਾਤਾਵਰਨ ਦੀ ਸਫਾਈ ਦਾ ਮੇਨ ਧਿਆਨ ਰੱਖਣਾ ਚਾਹੀਦਾ ਹੈ ਜਿਸ ਕਰਕੇ ਇਹ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ